ਇੱਕ ਦਿਨ ਮੈਂ ਆਪਣੇ ਫੋਨ 'ਤੇ ਔਨਲਾਈਨ ਸੇਲ ਸਰਚ ਕਰ ਰਹੀ ਸੀ ਜਿਹਦੇ ਵਿੱਚ ਮੈਨੂੰ ਔਨਲਾਈਨ ਕ੍ਰੋਕਰੀ ਦਾ ਸਮਾਨ ਜਿਹੜਾ ਉਹ ਬਹੁਤ ਵਧੀਆ ਲੱਗਿਆ ਅਤੇ ਮੈਂ ਉਹ ਕ੍ਰੋਕਰੀ ਦਾ ਸਮਾਨ ਔਡਰ ਕੀਤਾ ਜਿਹਦੇ ਅ ਜਦੋਂ ਮੈ ਕ੍ਰੋਕਰੀ ਦਾ ਸਮਾਨ ਔਡਰ ਕੀਤਾ ਇਹ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਸਮਾਨ ਆ ਬਹੁਤ ਜ਼ਿਆਦਾ ਲੇਟ ਆਇਆ ਅਤੇ ਦੂਸਰੀ ਗੱਲ ਇਹ ਹੈ ਕਿ ਜੋ ਕ੍ਰੋਕਰੀ ਦਾ ਸਮਾਨ ਵਿੱਚ ਬਹੁਤ ਜ਼ਿਆਦਾ ਖ਼ਰਾਬ ਸੀਗਾ ਇਹਦੇ ਵਿੱਚ ਕੁਛ ਭਾਂਡੇ ਜਿਵੇਂ ਕੱਪ ਵਗੈਰਾ ਉਹਨਾਂ ਵਿੱਚ ਤਰੇੜਾਂ ਆਈਆਂ ਹੋਈਆਂ ਸੀ ਅਤੇ ਕੁਝ ਪਲੇਟਾਂ ਵੀ ਟੁੱਟੀਆਂ ਹੋਈਆਂ ਸਨ ਇਸ ਤੋਂ ਬਾਅਦ ਮੈਂ ਉਹਨਾਂ ਨੂੰ ਸ਼ਿਕਾਇਤ ਕੀਤੀ ਪਰ ਉਹਨਾਂ ਨੇ ਇਸ ਗੱਲ ਦਾ ਕੋਈ ਅ ਉੱਤਰਦਾਈ ਜਿਹੜੀ ਹੈ ਉਹ ਨਹੀਂ ਦਿੱਤੀ ਇਸ ਲਈ ਜਿਹੜਾ ਕ੍ਰੋਕਰੀ ਦਾ ਸਾਰਾ ਸਮਾਨ ਆ ਉਹ ਖ਼ਰਾਬ ਸੀਗਾ ਅਤੇ ਔਨ ਇਸ ਤਰ੍ਹਾਂ ਆਪਾਂ ਨੂੰ ਔਨਲਾਈਨ ਦੀ ਜਗ੍ਹਾ ਔਫਲਾਈਨ ਜਿਹੜਾ ਖੁਦ ਸ਼ੋਪ 'ਤੇ ਚੱਲ ਕੇ ਹੀ ਚੀਜ਼ ਦੇਖ ਕੇ ਪਰਖ ਕੇ ਖਰੀਦਣੀ ਚਾਹੀਦੀ ਹੈ ਔਨਲਾਈਨ ਦੇ ਮੁਕਾਬਲੇ ਔਫਲਾਈਨ ਸਾਨੂੰ ਜ਼ਿਆਦਾ ਚੀਜ਼ ਅ ਲੈਣੀ ਚਾਹੀਦੀ ਹੈ ਕਿਉਂਕਿ ਉਸ ਨੂੰ ਆਪਾਂ ਹੱਥੀਂ ਦੇਖ ਸਕਦੇ ਹਾਂ ਅਤੇ ਉਹਦੀ ਆਪਾਂ ਸ਼ਿਕਾਇਤ ਵੀ ਕਰ ਸਕਦੇ ਹਾਂ ਇਸ ਲਈ ਔਨ ਅ ਇਸ ਲਈ ਆਪਾਂ ਨੂੰ ਹਾਂ ਕ੍ਰੋਕਰੀ ਦੇ ਸਮਾਨ ਹਮੇਸ਼ਾ ਦੇਖ ਕੇ ਪਰਖ ਕੇ ਹੀ ਲੈਣਾ ਚਾਹੀਦਾ ਹੈ ਕਿਸੇ ਦੁਕਾਨ ਤੋਂ